ਟਕਨੋਲਜੀ ਨੇ ਡਾਕਟਰੀ ਲੋੜਾਂ ਪੂਰੀਆਂ ਕਰਨ 'ਚ ਬਹੁਤ ਮਦਦ ਕੀਤੀ ਹੈ ਤੁਸੀਂ ਗੂਗਲ ਤੋਂ ਕੋਈ ਦਵਾਈ ਵਗੈਰਾ ਸਰਚ ਕਰ ਸਕਦੇ ਓ ਅਗਰ ਤੁਹਾਨੂੰ ਥੋੜੀ ਬਹੁਤ ਨੌਲੇਜ ਹੈਗੀ ਹੈ ਤਾਂ ਉਹਦੇ ਅਲਟਰਟ ਵੀ ਲੱਭ ਸਕਦੇ ਓ ਅਤੇ ਦੂਸਰਾ ਨੰਬਰ 'ਤੇ ਕੋਈ ਆਯੁਰਵੈਦਿਕ ਦਵਾਈ ਚਾਹੀਦੀ ਹੈਗੀ ਸਾਨੂੰ ਕਿਸ ਰੋਗ ਲਈ ਹੈ ਕਿੰਨੀ ਚਾਹੀਦੀ ਹੈ ਤੁਸੀਂ ਉਹ ਵੀ ਪਤਾ ਕਰ ਸਕਦੇ ਹੋ ਇਸ ਤੋਂ ਇਲਾਵਾ ਅੰਗਰੇਜ਼ੀ ਦਵਾਈਆਂ ਬਾਰੇ ਬਹੁਤ ਸਾਰੀ ਆਪਸ਼ਨ ਹੈਗੀਆਂ ਹਨ ਉਹਨਾਂ ਦਾ ਕੋਈ ਅਲਟਰੇਟ ਦੇਖਣਾ ਹੋਵੇ ਕੋਈ ਉਹਦੇ ਕੰਪਨੀ ਖਾਸ ਹੋਵੇ ਉਹ ਵੀ ਦੇਖ ਸਕਦੇ ਹੋ ਅਤੇ ਹੋਮਪੈਥਿਕ ਦਵਾਈ ਅਗਰ ਤੁਸੀਂ ਲੈਣੀ ਓ ਤੁਸੀਂ ਆਪਣੇ ਸਿਮਟਮ ਦੱਸ ਦੋ ਕਿਹੜੇ ਸਮੇਂ ਤੋਂ ਹੈਗੇ ਨੇ ਤਾਂ ਉੱਥੋਂ ਤੁਸੀਂ ਉਹ ਵੀ ਉਹ ਔਡਰ ਏ ਕਰ ਸਕਦੇ ਓ ਅਤੇ ਤੁਹਾਨੂੰ ਕਿਹੜੀ ਕਿਹੜਾ ਸਾਲਟ ਕਿਹੜੀ ਕਿਹੜੀ ਕੁਆਂਟੀਟੀ ਚਾਹੀਦਾ ਤੁਹਾਨੂੰ ਉਹ ਵੀ ਪਤਾ ਲੱਗ ਸਕਦਾ ਅਤੇ ਅਗਰ ਕੋਈ ਡੋਕਟਰ ਦੇਖਣਾ ਹੋਵੇ ਨਜ਼ਦੀਕ ਤਾਂ ਤੁਸੀਂ ਗੂਗਲ ਮੈਪ ਤੋਂ ਉਹ ਵੀ ਦੇਖ ਸਕਦੇ ਓ ਉਹਦੇ ਨਾਲ ਇੱਕ ਮਸਟਡ ਆਇਲ ਹੈਗੀ ਵੈਬਸਾਈਟ ਜਾਂ ਐਪ ਹੈਗੀ ਹੈ ਉਥੋਂ ਵੀ ਕੋਈ ਵਧੀਆ ਜਿਹੜਾ ਡੋਕਟਰ ਹੈਗਾ ਸਾਨੂੰ ਉਹਦੇ ਬਾਰੇ ਪਤਾ ਲੱਗ ਜਾਂਦਾ ਅਤੇ ਇੱਕ ਵਨ ਐੱਮ ਜੀ ਕੰਪਨੀ ਹੈਗੀ ਹੈ ਔਨਲਾਈਨ ਤੁਸੀਂ ਉਥੋਂ ਵੀ ਦਵਾਈਆਂ ਵਗੈਰਾ ਔਡਰ ਕਰ ਸਕਦੇ ਹੋ ਇਸ ਤਰ੍ਹਾਂ ਬਹੁਤ ਸਾਰੀ ਮਦਦ ਕੀਤੀ ਹੈ ਟੈਕਨੋਲਜੀ ਨੇ